ਹੈਲੋ ਸਤਿ ਸ਼੍ਰੀ ਅਕਾਲ ਸਰ ਸਰ ਮੈਂ ਨਾ ਕੁਲਵਿੰਦਰ ਕੌਰ ਬੋਲਣ ਡੀ ਹਾਂ ਰਾਜਸਥਾਨ ਤੋਂ ਤੁਸੀਂ ਮੇਰੇ ਟੂਰਿਸਟ ਗਾਈਡ ਹੋ ਅਤੇ ਅਸੀਂ ਨਾ ਬੱਚਿਆਂ ਦੇ ਨਾਲ ਨਾ ਤੁਹਾਡੇ ਇਲਾਕੇ ਦੇ ਵਿੱਚ ਘੁੰਮਣ ਆਉਣਾ ਚਾਹੁੰਦੇ ਹਾਂ ਕੀ ਤੁਹਾਡੇ ਇਲਾਕੇ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨਾਲ ਰਿਲੇਟਿਡ ਕੁਛ ਹੈ ਕੋਈ ਜਗ੍ਹਾ ਵਗੈਰਾ ਜੋ ਤੁਸੀਂ ਜਾਂ ਉਹਨਾਂ ਦੀ ਕੋਈ ਹਿਸਟਰੀ ਬੱਚਿਆਂ ਨੂੰ ਦੱਸ ਸਕਦੇ ਹੋ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਉਹੀ ਨਾ ਬੱਚਿਆਂ ਨੂੰ ਹਿਸਟਰੀ ਬਾਰੇ ਪੂਰਾ ਪਤਾ ਹੋਣਾ ਚਾਹੀਦਾ ਹਾਂਜੀ ਠੀਕ ਆ ਸਰ ਹਾਂਜੀ ਹਾਂਜੀ ਠੀਕ ਆ ਠੀਕ ਆ ਹਾਂਜੀ ਅਸੀਂ ਆਪਣੇ ਬੱਚਿਆਂ ਦੇ ਨਾਲ ਆਵਾਂਗੇ ਘੁੰਮਣ ਤੁਸੀਂ ਸਾਨੂੰ ਵੀ ਸਾਰਾ ਘੁੰਮਾ ਕੇ ਲਿਆਇਓ ਠੀਕ ਹੈ ਠੀਕ ਹੈ ਓਕੇ